ਹਾਂਜੀ ਸਾਡੀ ਰਸੋਈ ਦੇ ਵਿੱਚ ਬਹੁਤ ਸਾਰੇ ਬਰਤਨ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਵੱਖ ਵੱ ਖ ਤਰ੍ਹਾਂ ਦੀਆਂ ਚੀਜ਼ਾਂ ਜਾਂ ਭੋਜਨ ਬਣਾਉਣ ਦੇ ਲਈ ਵਰਤਿਆ ਜਾਂਦਾ ਜਿਵੇਂ ਅਸੀਂ ਕੜਾਹੀ ਨੂੰ ਲੈ ਸਕਦੇ ਹਾਂ ਅਸੀਂ ਕੜਾਹੀ ਦੇ ਵਿੱਚ ਪਕੌੜੇ ਵੀ ਕੱਢ ਸਕਦੇ ਹਾਂ ਅਸੀਂ ਕੜਾਹੀ ਦੇ ਵਿੱਚ ਕੋਈ ਸੁੱਕੀ ਸਬਜ਼ੀ ਬਣਾਉਣੀ ਹੋਏ ਤਾਂ ਤੜਕਾ ਲਗਾ ਕੇ ਉਸ ਨੂੰ ਬਣਾ ਸਕਦੇ ਹਾਂ ਅਤੇ ਜਾਂ ਫੇਰ ਮੰਨ ਲਉ ਅਸੀਂ ਸਰਦੀਆਂ ਦੇ ਵਿੱਚ ਕੋਈ ਪਿੰਨੀਆਂ ਬਣਾਉਣੀਆਂ ਨੇ ਵੇਸਣ ਭੁੰਨਣਾ ਹੈ ਆਟਾ ਭੁੰਨਣਾ ਹੈ ਜਾਂ ਫਿਰ ਅਲਸੀ ਦੇ ਦੇ ਲਈ ਚਾਸ਼ਨੀ ਤਿਆਰ ਕਰਨੀ ਹੈ ਤਾਂ ਕੜਾਹੀ ਦੇ ਵਿੱਚ ਉਹ ਵੀ ਤਿਆਰ ਹੋ ਸਕਦੀ ਹੈ ਇਸ ਤਰ੍ਹਾਂ ਘਰਾਂ ਦੇ ਵਿੱਚ ਪਤੀਲੇ ਹੁੰਦੇ ਨੇ ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਛੋਟੀ ਮਧਾਣੀ ਦੇ ਨਾਲ ਮੱਖਣ ਜਾਂ ਲੱਸੀ ਬਣਾਉਣ ਦੇ ਲਈ ਵਰਤ ਸਕਦੇ ਹਾਂ ਸਾਗ ਬਣਾਉਣ ਦੇ ਲਈ ਵਰਤ ਸਕਦੇ ਹਾਂ ਅਤੇ ਉਹਦੇ ਵਿੱਚ ਵੀ ਅਸੀਂ ਦਾਲ ਜਾਂ ਸਬਜ਼ੀ ਜਿਹੜੀ ਹੈ ਉਹ ਬਣਾ ਸਕਦੇ ਹਾਂ ਇਸ ਪ੍ਰਕਾਰ ਘਰਾਂ ਦੇ ਵਿੱਚ ਮੰਨ ਲਉ ਕੜਛੀ ਹੁੰਦੀ ਹੈ ਤਾਂ ਕੜਛੀ ਦਾ ਵੀ ਅਸੀਂ ਕਈ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਅਸੀਂ ਸੁੱਕੀ ਸਬਜ਼ੀ ਬਣਾਉਣ ਦੇ ਲਈ ਜਾਂ ਕੋਈ ਦਾਲ ਬਣਾਉਣ ਦੇ ਲਈ ਜਾਂ ਫੇਰ ਆਟਾ ਵਗੈਰਾ ਭੁੰਨਣ ਦੇ ਲਈ ਕੜਾਹੀ ਦੇ ਵਿੱਚੋਂ ਉਸ ਨੂੰ ਵਾਰ ਵਾਰ ਹਿਲਾਉਣਾ ਹੋਏ ਤਾਂ ਵੀ ਕੜਛੀ ਦੀ ਜਿਹੜੀ ਹੈ ਉਹ ਵਰਤੋਂ ਹੁੰਦੀ ਹੈ ਤਾਂ ਕੁਝ ਪਲੇਟਾਂ ਹੁੰਦੀਆਂ ਨੇ ਪਲੇਟ ਦੇ ਵਿੱਚ ਜਿਹੜੀ ਸਾਡੀ ਥੋੜ੍ਹੀ ਵੱਡੀ ਪਲੇਟ ਹੁੰਦੀ ਜਿਵੇਂ ਕੁਆਟਰ ਪਲੇਟ ਹੁੰਦੀ ਹੈ ਉਹਦੇ ਵਿੱਚ ਅਸੀਂ ਰੋਟੀ ਤਾਂ ਖਾ ਹੀ ਲੈਂਦੇ ਹਾਂ ਪਰ ਕੋਈ ਸਬਜ਼ੀ ਕੱਟਣੀ ਹੋਏ ਤਾਂ ਉਹਦੇ 'ਚ ਕੱਟੀ ਜਾ ਸਕਦੀ ਹੈ ਅਸੀਂ ਉਹਦੇ ਵਿੱਚ ਰੱਖ ਸਕਦੇ ਹਾਂ ਜਾਂ ਅਸੀਂ ਕੋਈ ਫਰੂਟ ਕੱਟ ਕੇ ਖਾਣਾ ਤਾਂ ਵੀ ਉਹਦੇ ਵਿੱਚ ਕੱਟ ਸਕਦੇ ਹਾਂ ਸਲਾਦ ਖਾ ਸਕਦੇ ਹਾਂ ਤਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਚੀਜ਼ ਵਸਤੂ ਸਰਵ ਕਰਨ ਦੇ ਲਈ ਉਸਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਤਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਰਸੋਈ ਦੇ ਵਿੱਚ ਜਿਨ੍ਹਾਂ ਦੀ ਅਸੀਂ ਵਰਤੋਂ ਵੱਖ ਵੱਖ ਤਰੀਕੇ ਦੇ ਨਾਲ ਕਰ ਸਕਦੇ ਹਾਂ ਜਿਵੇਂ ਬਿਨਾਂ ਸ਼ੱਕ ਜਿਹੜੇ ਕੁੱਕਰ ਨੇ ਉਹ ਮਤਲਬ ਸੀਟੀ ਮਾਰ ਕੇ ਕੋਈ ਰਾਜਮਾਂਹ ਛੋਲੇ ਜਾਂ ਦਾਲਾਂ ਬਣਾਉਂਦੇ ਨੇ ਜਿਨ੍ਹਾਂ ਨੂੰ ਪੱਕਣ ਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਤਾਂ ਅਸੀਂ ਉਹਨਾਂ ਦੀ ਵਰਤੋਂ ਜਿਹੜੀ ਹੈ ਆਲੂ ਉਬਾਲਣ ਲਈ ਵੀ ਕਰ ਲੈਂਦੇ ਹਾਂ ਜਾਂ ਉਹਨਾਂ ਦੇ ਵਿੱਚ ਹੀ ਅਸੀਂ ਚੌਲ ਵਗੈਰਾ ਬਣਾ ਲੈਂਦੇ ਹੁੰਦੇ ਹਾਂ ਜਾਂ ਜਿਵੇਂ ਅੱਜ ਕੱਲ੍ਹ ਘਰਾਂ ਦੇ ਵਿੱਚ ਜੇ ਤੰਦੂਰ ਨਹੀਂ ਹੈਗੇ ਤਾਂ ਕੁੱਕਰ ਨੂੰ ਗਰਮ ਕਰਕੇ ਉਹਦੇ ਵਿੱਚ ਕੋਈ ਚਾਰ ਪੰਜ ਫੁਲਕੇ ਤੰਦੂਰੀ ਵਰਗੇ ਬਣਾਉਣੇ ਹੋਣ ਤਾਂ ਤਾਂ ਵੀ ਬਣਾਏ ਜਾ ਸਕਦੇ ਨੇ ਕੁੱਕਰ ਦੇ ਵਿੱਚ ਹੀ ਜਿਹੜੇ ਲੋਕ ਨੇ ਉਹ ਕੇਕ ਵੀ ਬਣਾ ਲੈਂਦੇ ਨੇ ਇਸ ਪ੍ਰਕਾਰ ਅਸੀਂ ਰਸੋਈ ਵਿਚਲੇ ਵੱਖ ਵੱਖ ਬਰਤਨਾਂ ਨੂੰ ਵੱਖ ਵੱਖ ਤਰੀਕੇ ਦੇ ਨਾਲ ਵਰਤ ਸਕਦੇ ਹਾਂ